ਮੈਨੂੰ ਨਾ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਆ ਅਤੇ ਮੈਂ ਨਾ ਇੱਕ ਵਾਰੀ ਮਤਲਬ ਨੈਣਾ ਦੇਵੀ ਗਈ ਸੀਗੀ ਅਤੇ ਉੱਥੇ ਮਤਲਬ ਉਹ ਜਿਹੜੇ ਮਤਲਬ ਨੈਣਾ ਦੇਵੀ ਜੋ ਮਾਤਾ ਦਾ ਮੰਦਰ ਹੈਗਾ ਨਾ ਉਹ ਮਤਲਬ ਕਾਫੀ ਉੱਚੀ ਪਹਾੜੀ 'ਤੇ ਸਥਿਤ ਹੈਗਾ ਆ ਅਤੇ ਉੱਥੇ ਉੱਥੇ ਮਤਲਬ ਕਿ ਜਾਣ ਲਈ ਕੋਈ ਬੱਸ ਜਾਂ ਕੁਛ ਹੋਰ ਨਹੀਂ ਜਾਂਦਾ ਮਤਲਬ ਸ ਪੌੜੀਆਂ ਨਾਲ ਹੀ ਚੜਨਾ ਪੈਂਦਾ ਆ ਅਤੇ ਜਦੋਂ ਮਤਲਬ ਸ ਪੌੜੀਆਂ ਮੈਂ ਦੇਖੀਆਂ ਮੈਨੂੰ ਤਾਂ ਮਤਲਬ ਡਰ ਵਗੈਰਾ ਵੀ ਬਹੁਤ ਲੱਗਿਆ ਹੈ ਨਾ ਕਿ ਹਾਂ ਇੱਨੀ ਉੱਚੀ ਚੜੋਂਗੇ ਕਿੱਦਾਂ ਪਰ ਹੈ ਨਾ ਮਤਲਬ ਹੌਲੀ ਹੌਲੀ ਜਦ ਮੇਰੇ ਘਰ ਦੇ ਨਾਲ ਸੀਗੇ ਇਸ ਕਰਕੇ ਮੈਂ ਨਾ ਉਸ ਪੌੜੀਆਂ ਵਗੈਰਾ 'ਤੇ ਚੜੀ ਹੌਲੀ ਹੌਲੀ ਕਰਕੇ ਅਤੇ ਫਿਰ ਉਸ ਤੋਂ ਬਾਅਦ ਜਦੋਂ ਮਤਲਬ ਘਰਦਿਆਂ ਨਾਲ ਜ ਗਈ ਉੱਪਰ ਜਦੋਂ ਮੱਥਾ ਵਗੈਰਾ ਟੇਕ ਕੇ ਅਸੀਂ ਵਾਪਸ ਆਏ ਅਤੇ ਉਸ ਤੋਂ ਬਾਅਦ ਮਤਲਬ ਮੈਨੂੰ ਹੋਰ ਡਰ ਲੱਗਿਆ ਕਿ ਹਾਂ ਕਿ ਹੁਣ ਫਿਰ ਮਤਲਬ ਕਿ ਹੈ ਨਾ ਨੀਚੇ ਤੱਕ ਜਾਣਾ ਮਤਲਬ ਥੱਲੇ ਤੱਕ ਫਿਰ ਅੱਗੇ ਤੁਰਨਾ ਪੈਣਾ ਇੰਨਾਂ ਅਤੇ ਉਸ ਤੋਂ ਬਾਅਦ ਜਦੋਂ ਮੈਂ ਆਉਂਦੇ ਆਉਂਦੇ ਮਤਲਬ ਫਿਰ ਮੈਂ ਮੈਨੂੰ ਫਿਰ ਇਸ ਤੋਂ ਬਾਅਦ ਜਦ ਮੈਂ ਨੀਚੇ ਉੱਤਰ ਗਈ ਫਿਰ ਮੈਨੂੰ ਥੋੜ੍ਹੀ ਬਹੁਤ ਸ਼ਾਂਤੀ ਜੀ ਹੋਈ